ਮੈਂ ਕੁਛ ਸਮਾਨ ਲੈ ਕੇ ਆਇਆ ਸੀ ਕੁਛ ਦੁਕਾਨ 'ਤੇ ਗਿਆ ਸੀ ਮੋਲ ਦੇ ਵਿੱਚ ਕਹਿੰਦੇ ਮਾਲ ਦੇ ਵਿੱਚ ਬਹੁਤ ਵਧੀਆ ਸਸਤਾ ਇੱਕ ਦੇ ਨਾਲ ਇੱਕ ਫਰੀ ਸਮਾਨ ਮਿਲਦਾ ਇੱਕ ਦੇ ਨਾਲ ਇੱਕ ਸਮੇਤ ਸਮਾਨ ਦੇ ਹਿਸਾਬ ਨਾਲ ਮੈਂ ਸਮਾਨ ਲੈ ਕੇ ਆਇਆ ਜੋ ਬਿਲਕੁਲ ਬੇਕਾਰ ਬੇਬੂਦਾ ਬਿਲਕੁਲ ਬੇਕਾਰ ਨਿਕਲਿਆ